ਹਾਂਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਪੰਛੀ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਅਤੇ ਅਸੀਂ ਕਈ ਤਰੀਕਿਆਂ ਨਾਲ ਬਾਗਾਂ ਅਤੇ ਵਿਹੜੇ ਵਿੱਚ ਪੰਛੀਆਂ ਨੂੰ ਮਿਲਣ ਨੂੰ ਅਕਰਸ਼ਿਤ ਕਰਦੇ ਹਾਂ ਹਾਂਜੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਜਿਵੇਂ ਕਿ ਅਸੀਂ ਉਨ੍ਹਾਂ ਲਈ ਚੋਗਾ ਅਤੇ ਪਾਣੀ ਰੱਖਦੇ ਹਾਂ ਰੱਖ ਸਕਦੇ ਹਾਂ ਇਸ ਤੋਂ ਇਲਾਵਾ ਉਨ੍ਹਾਂ ਲਈ ਅਸੀਂ ਆਲ੍ਹਣੇ ਵੀ ਰੱਖ ਸਕਦੇ ਹਾਂ ਇਸ ਤੋਂ ਜੋ ਉਹ ਰਹਿ ਸਕਣ ਮੈਂ ਅਕਸਰ ਪੰਛੀਆਂ ਲਈ ਪਾਣੀ ਅਤੇ ਦਾਣੇ ਰੱਖਦੀ ਹਾਂ ਅਤੇ ਰੋਜ਼ ਸਵੇਰੇ ਆਪਣੀ ਛੱਤ ਉੱਪਰ ਕਬੂਤਰਾਂ ਨੂੰ ਦਾਣੇ ਪਾਉਂਦੀ ਹਾਂ ਤਾਂ ਜੋ ਕਿ ਭੁੱਖੇ ਨਾ ਰਹਿ ਸਕਣ ਹਰ ਤਰ੍ਹਾਂ